ਜੇਕਰ ਮੈਂ ਪੌਦਿਆਂ ਬਾਰੇ ਗੱਲ ਕਰਾਂ ਤਾਂ ਮੈਨੂੰ ਪੌਦੇ ਬਹੁਤ ਹੀ ਪਸੰਦ ਹਨ ਮੈਂ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਗਾਰਡਨ ਬਣਾਇਆ ਹੋਇਆ ਹੈ ਅਤੇ ਉੱਥੇ ਮੈਂ ਗਾਰਡਨਿੰਗ ਕਰਦੀ ਹਾਂ ਮੈਨੂੰ ਪਰਸਨਲੀ ਗਾਰਡਨਿੰਗ ਬਹੁਤ ਪਸੰਦ ਹੈ ਅਤੇ ਮੈਨੂੰ ਕੁਝ ਕੁ ਪੌਦਿਆਂ ਬਾਰੇ ਜਾਣਕਾਰੀ ਵੀ ਹੈ ਪਰ ਮੈਨੂੰ ਇੰਨੀ ਵੀ ਜਾਣਕਾਰੀ ਨਹੀਂ ਹੈ ਇਸ ਲਈ ਮੈਂ ਉਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਕੁਛ ਯੂਟਿਊਬ 'ਤੇ ਕੁਛ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਜਿਸ ਨਾਲ ਮੈਨੂੰ ਪੌਦਿਆਂ ਬਾਰੇ ਪਤਾ ਲੱਗਦਾ ਰਹਿੰਦਾ ਹੈ ਅਤੇ ਉਨ੍ਹਾਂ ਦੀ ਨਵੀਆਂ ਨਵੀਆਂ ਤਕਨੀਕਾਂ ਬਾਰੇ ਪਤਾ ਲੱਗਦਾ ਹੈ ਅਤੇ ਵੇਸੇ ਤਾਂ ਮੈਨੂੰ ਜ਼ਿਆਦਾ ਫਲਾਵਰਸ ਪਸੰਦ ਹਨ ਜਿਵੇਂ ਕਿ ਰੋਜ਼ ਜਾਂ ਲੀਲੀ ਮੈਨੂੰ ਫਲਾਵਰਸ ਉਗਾਉਣੇ ਬਹੁਤ ਪਸੰਦ ਹਨ ਮੇਰੇ ਗਾਰਡਨ ਵਿੱਚ ਜ਼ਿਆਦਾਤਰ ਮੇ ਜ਼ਿਆਦਾਤਰ ਮੇਨੇ ਫਲਾਵਰਸ ਹੀ ਉਗਾਏ ਹੋਏ ਹਨ ਅਤੇ ਮੈਨੂੰ ਸਬਜ਼ੀਆਂ ਮੈਂ ਸਬਜ਼ੀਆਂ ਵੀ ਉਗਾਉਂਦੀ ਹਾਂ ਜਿਵੇਂ ਕਿ ਸਰਦੀਆਂ ਵਿੱਚ ਕਾਫ਼ੀ ਤਰ੍ਹਾਂ ਦੀਆਂ ਸਬਜ਼ੀਆਂ ਆਉਂਦੀਆਂ ਹਨ ਅਤੇ ਮੇਨੇ ਉਹ ਵੀ ਉਗਾਈਆਂ ਵੀਆਂ ਨੇ ਅਤੇ ਇਸ ਨਾਲ ਅਸੀਂ ਘਰ ਦੀਆਂ ਉੱਗੀਆਂ ਹੋਈਆਂ ਸਬਜ਼ੀਆਂ ਹੀ ਖਾਂਦੇ ਹਾਂ ਜਿਸ ਨਾਲ ਕੋਈ ਬਿਮਾਰੀ ਵੀ ਨਹੀਂ ਲੱਗਦੀ ਇਸ ਨਾਲ ਬਹੁਤ ਫਾਇਦਾ ਹੁੰਦਾ ਹੈ ਜੇ ਸਾਲ ਕੁ ਪਹਿਲਾਂ ਸਾਡੇ ਪਟਿਆਲਾ ਸ਼ਹਿਰ ਵਿੱਚ ਬਾਰਾਡਰੀ ਗਾਰਡਨ ਵਿੱਚ ਫਲਾਵਰ ਸ਼ੋਅ ਹੋਇਆ ਸੀ ਜਿੱਥੇ ਮੈਨੂੰ ਫਲਾਵਰਸ ਬਾਰੇ ਬਹੁਤ ਜਾਣਕਾਰੀ ਮੇਨੇ ਇਕੱਠਾ ਕੀਤੀ ਉੱਥੇ ਮੈਨੂੰ ਕਈ ਕਈ ਤਰ੍ਹਾਂ ਦੇ ਫਲਾਵਰਸ ਬਾਰੇ ਪਤਾ ਲ ਲੱਗਿਆ ਅਤੇ ਉਨ੍ਹਾਂ ਨੇ ਹਰੇਕ ਤਰ੍ਹਾਂ ਦੀ ਫਲਾਵਰ ਦੀ ਜਾਣਕਾਰੀ ਬਹੁਤ ਚੰਗੀ ਤਰ੍ਹਾਂ ਦਿੱਤੀ ਹੋਈ ਸੀ ਉੱਥੇ ਕਈ ਖਾਦਾਂ ਵੀ ਖਾਦਾਂ ਬਾਰੇ ਵੀ ਦੱਸਿਆ ਹੋਇਆ ਸੀ ਮੇੇਨੇ ਕੁਛ ਉੱਥੋ ਮੇਨੇ ਕੁਛ ਪੌਦੇ ਵੀ ਖਰੀਦੇ ਅਤੇ ਉੱਥੋਂ ਮੇੇਨੇ ਖਾਦ ਵੀ ਖਰੀਦੀ ਅਤੇ ਮੇਨੇ ਉਨ੍ਹਾਂ ਚੀਜ਼ਾਂ ਦਾ ਇਸਤੇਮਾਲ ਵੀ ਕੀਤਾ ਉਹਨਾਂ ਨਾਲ ਮੇਰੇ ਪੌਦੇ ਬਹੁਤ ਹੀ ਜ਼ਿਆਦਾ ਉਹਨਾਂ ਦੀ ਗਰੋਥ ਬਹੁਤ ਵਧੀਆ ਹੋਈ ਜਿਸ ਨਾਲ ਮੈਨੂੰ ਉਹ ਸ਼ੋਅ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਅਤੇ ਹੁਣ ਜਦੋਂ ਵੀ ਉਹ ਸ਼ੋਅ ਲੱਗੇਗਾ ਤਾਂ ਮੈਂ ਉਸ ਸ਼ੋਅ ਦੀ ਬਹੁਤ ਜ਼ਿਆਦਾ ਵੇਟ ਕਰਾਂਗੀ